ਹਾਲ ਹੀ ਵਿੱਚ ਮੈਂ ਲੋਹੜੀ ਦਾ ਤਿਉਹਾਰ ਮਨਾਇਆ ਜਿਸ ਤਿਉਹਾਰ ਦਾ ਮੈਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹਰ ਸਾਲ ਇਸ ਤਿਉਹਾਰ 'ਚ ਅਸੀਂ ਸਵੇਰੇ ਸਵੇਰੇ ਸਾਰਾ ਪਰਿਵਾਰ ਆਪਣੇ ਆਪਣੇ ਕੋਠੇ ਚੜਦੇ ਹਾਂ ਅਤੇ ਪਤ ਖੂਬ ਪਤੰਗ ਉੜਾਉਂਦੇ ਹਾਂ ਸਾਰਾ ਦਿਨ ਖੂਬ ਮਸਤੀ ਦੇ ਨਾਲ ਪਤੰਗਾ ਉੜਾ ਕੇ ਰਾਤ ਦੇ ਟਾਈਮ ਸਾਰਾ ਪਰਿਵਾਰ ਇਕੱਠੇ ਹੋ ਕੇ ਭੁ ਭੁਗਾ ਬਾਲਦਾ ਹੈ ਜਿਹਦੇ ਵਿੱਚ ਸਾਰੇ ਮਿਲ ਕੇ ਹੱਸਦੇ ਗਾਉਂਦੇ ਨੱਚਦੇ ਇਹ ਤਿਉਹਾਰ ਨੂੰ ਮਨਾਉਂਦੇ ਹਾਂ ਫਿਰ ਸਾਰੇ ਮਿਲ ਜੁਲ ਕੇ ਰਾਤ ਨੂੰ ਅਸੀਂ ਰੋਟੀ ਖਾ ਕੇ ਇਹ ਤਿਉਹਾਰ ਨੂੰ ਪੂਰੀ ਰੌਣਕ ਦੇ ਨਾਲ ਮਨਾਏ ਜਾਂਦੇ ਹਨ